ਹਾਂਜੀ ਅਸੀਂ ਆਪਣੇ ਬੱਚਿਆਂ ਨੂੰ ਬੈਂਕਿੰਗ ਖੇਤਰ ਨੂੰ ਕਰੀਅਰ ਬਣਾਉਣ ਦੀ ਤਰਜੀਹ ਦੇਵਾਂਗੇ ਅਸੀਂ ਉਹਨਾਂ ਨੂੰ ਪ੍ਰੇਰਿਤ ਕਰਾਂਗੇ ਕਿ ਉਹ ਚੰਗੀ ਵਿੱਦਿਆ ਪ੍ਰਾਪਤ ਕਰਨ ਉਦਾਹਰਨ ਦੇ ਵਜੋਂ ਜਿੱਦਾਂ ਬੀ ਕੌਮ ਵਗੈਰਾ ਆਦਿ ਡਿਗਰੀਆਂ ਲੈਣ ਅਤੇ ਉਹ ਬੈਂਕਿੰਗ ਖੇਤਰ ਦੇ ਵੱਲ ਜਾ ਸਕਣ ਇਸ ਦੇ ਨਾਲ ਉਹਨਾਂ ਨੂੰ ਵਿਕਾਸ ਦੇ ਬਹੁਤ ਸਾਰੇ ਮੌਕੇ ਮਿਲਣਗੇ ਆਪਣਾ ਕਰੀਅਰ ਬਣਾਉਣ ਵਾਸਤੇ ਬੈਂਕਿੰਗ ਖੇਤਰ ਵਿੱਚ ਸਮਾਜ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਇਸ ਖੇਤਰ ਵਿੱਚ ਕੰਮ ਕਰਕੇ ਵਿਅਕਤੀ ਸਮਾਜ ਵਿੱਚ ਯੋਗਦਾਨ ਪਾ ਸਕਦਾ ਹੈ ਅਤੇ ਇੱਕ ਆਦਰਸ਼ ਮਾਤਾ ਪਿਤਾ ਦੀ ਭੂਮਿਕਾ ਵੀ ਇਹੀ ਹੋਵੇਗੀ ਕਿ ਉਹ ਬੱਚਿਆਂ ਨੂੰ ਕੁਦਰਤੀ ਪ੍ਰਤੀਭਾਵਾਂ ਅਤੇ ਰੁਚੀਆਂ ਨੂੰ ਪਛਾਨਣ ਅਤੇ ਉਹਨਾਂ ਨੂੰ ਉਤਸਾਹਿਤ ਕਰਨ ਅਤੇ ਉਹ ਸਿੱਖਿਆ ਨੂੰ ਵੀ ਉਤਸਾਹਿਤ ਕਰਨ ਅਤੇ ਉਹਨਾਂ ਦੇ ਬੱਚੇ ਜਿਹੜੇ ਉਹ ਸਿੱਖਿਆ ਉਚਿਤ ਸਿੱਖਿਆ ਪ੍ਰਾਪਤ ਕਰਕੇ ਜਿਵੇਂ ਕਿ ਬੈਂਕਿੰਗ ਅਤੇ ਵਿੱਤ ਵਿੱਚ ਡਿਗਰੀ ਲੈ ਕੇ ਉਸ ਨੂੰ ਚੰਗੀ ਸੇਧ ਦੇ ਸਕਣ ਉਹ ਬੱਚਿਆਂ ਨੂੰ ਬੈਂਕਿੰਗ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਨਾਲ ਮਿਲਣ ਦੇ ਮੌਕੇ ਪ੍ਰਦਾਨ ਕਰਨ ਤਾਂ ਕਿ ਉਹ ਬਹੁਤ ਕੁਝ ਸਿੱਖ ਸੱਖਣ ਅਤੇ ਇਹ ਧਿਆਨ ਰੱਖਣਾ ਬਹੁਤ ਮਹੱਤਵਪੂਰਨ ਹੈ ਕਿ ਬੱਚੇ ਨੂੰ ਕਿਸੇ ਖਾਸ ਕੈਰੀਅਰ ਨੂੰ ਅਪਣਾਉਣ ਲਈ ਮਜਬੂਰ ਨਾ ਕੀਤਾ ਜਾਵੇ ਉਹ ਬੱਚੇ ਖੁਦ ਆਪਣਾ ਫੈਸਲਾ ਆਪ ਲੈ ਸਕਣ ਜਦੋਂ ਉਹ ਇਸ ਦੇ ਯੋਗ ਹੋ ਜਾਣ ਅਤੇ ਮਾਤਾ ਪਿਤਾ ਸਿਰਫ ਉਹਨਾਂ ਦਾ ਸਮਰਥਨ ਹੀ ਕਰਨ ਅਤੇ ਅਸੀਂ ਆਪਣੇ ਬੱਚਿਆਂ ਨੂੰ ਇਸ ਕਰਕੇ ਬੈਂਕਿੰਗ ਖੇਤਰ ਵਿੱਚ ਜਾਣ ਦੀ ਤਰਜੀਹ ਦੇਵਾਂਗੇ